ਮੈਨੂੰ ਖਾਣਾ ਬਣਾਉਣ ਦਾ ਬੜਾ ਹੀ ਸ਼ੌਕ ਹੈ ਅਤੇ ਖਾਣਾ ਬਣਾਉਣ 'ਚ ਅੱਜ ਤੱਕ ਮੈਂ ਕਿਸੇ ਵੈਸੇ ਮੁਕਾਬਲੇ 'ਚ ਹਿੱਸਾ ਤਾਂ ਨਹੀਂ ਲਿਆ ਮੈਨੂੰ ਕੁ ਕੁਕਿੰਗ ਦਾ ਖਾਣਾ ਬਣਾਉਣ ਦਾ ਸ਼ੌਕ ਮੈਨੂੰ ਸਕੂਲ ਟਾਈਮ ਤੋਂ ਸੀ ਸਕੂਲ ਟਾਈਮ ਦੇ ਵਿੱਚ ਮੈਂ ਹੋਮ ਸਾਇੰਸ ਲਈ ਹੋਈ ਸੀ ਅਤੇ ਜਦੋਂ ਸਾਡਾ ਹੋਮ ਸਾਇੰਸ ਦਾ ਪੇਪਰ ਹੋਇਆ ਸੀ ਤਾਂ ਪਹਿਲੀ ਵਾਰ ਮੈਂ ਆਲੂ ਦੇ ਪਰਾਂਠੇ ਬਣਾ ਕੇ ਲੈ ਕੇ ਗਈ ਸੀ ਅਤੇ ਚਾਵਲ ਬਣਾ ਕੇ ਲੈ ਕੇ ਗਈ ਸੀ ਜੋ ਮੇਰੇ ਅਧਿਆਪਕਾਂ ਨੂੰ ਬੜੇ ਹੀ ਪਸੰਦ ਆਏ ਸੀ ਉਸ ਤੋਂ ਬਾਅਦ ਮੈਂ ਹੁਣ ਅੱਜ ਦੇ ਟਾਈਮ 'ਚ ਸਾਰਾ ਖਾਣਾ ਬਣਾਉਣਾ ਸਾਰਾ ਕੁਛ ਸਿੱਖ ਚੁੱਕੀ ਹਾਂ ਮੈਨੂੰ ਜਿਹੜਾ ਮਰਜ਼ੀ ਪਕਵਾਨ ਹੋਵੇ ਮੈਂ ਬਹੁਤ ਹੀ ਵਧੀਆ ਬਣਾਉਂਦੀ ਹਾਂ ਚਾਹੇ ਉਹ ਸ਼ਾਹੀ ਪਨੀਰ ਹੋਵੇ ਕੜਾਹੀ ਪਨੀਰ ਹੋਵੇ ਸਰਸੋਂ ਦਾ ਸਾਗ ਹੋਵੇ ਪਾਲਕ ਪਨੀਰ ਹੋਵੇ ਆਲੂ ਦੇ ਪਰਾਂਠੇ ਹੋਣ ਅਤੇ ਮੈਂ ਬੜੇ ਹੀ ਵਧੀਆ ਬਣਾਉਂਦੀ ਹਾਂ